ਖਾਣਾ ਬਣਾਉਣ ਵੇਲੇ ਸਿਰਫ਼ ਖਾਣੇ ਦਾ ਹੀ ਨਹੀਂ ਉਸ ਨੂੰ ਬਣਾਉਣ ਤੋਂ ਪਹਿਲਾਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਧਿਆਨ ਹੈ ਰੱਖਣਾ ਪੈਂਦਾ ਹੈ ਜਿਵੇਂ ਕਿ ਖਾਣਾ ਬਣਾਉਣ ਵੇਲੇ ਸਾਡੀਆਂ ਜਿਹੜੀਆਂ ਸਬਜ਼ੀਆਂ ਹੁੰਦੀਆਂ ਨੇ ਉਹ ਤਾਜ਼ੀਆਂ ਹੋਣੀਆਂ ਚਾਹੀਦੀਆਂ ਨੇ ਜਿਹੜੀ ਇਹ ਬਾਸੀ ਸਬਜ਼ੀ ਆਪਾਂ ਅਗਰ ਲੈ ਕੇ ਖਾਣਾ ਬਣਾਉਂਦੇ ਹਾਂ ਤਾਂ ਉਹ ਖਾਣੇ ਦਾ ਜਿਹੜਾ ਸੁਆਦ ਹੈ ਉਹ ਇੰਨਾ ਵਧੀਆ ਨਹੀਂ ਆ ਪਾਉਂਦਾ ਜਿੰਨਾ ਕਿ ਸਾਨੂੰ ਚਾਹੀਦਾ ਹੁੰਦਾ ਹੈ ਇਸ ਕਰਕੇ ਜਿਹੜੀਆਂ ਤਾਜ਼ ਸਬਜ਼ੀਆਂ ਨੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜ਼ਿਆਦਾਤਰ ਅਸੀਂ ਤਾਜ਼ੀਆਂ ਸਬਜ਼ੀਆਂ ਦੀ ਹੀ ਵਰਤੋਂ ਕਰੀਏ ਫਰਿੱਜ਼ ਦੇ ਵਿੱਚ ਬਹੁਤ ਪੁਰਾਣੀਆਂ ਰੱਖੀਆਂ ਹੋਈਆਂ ਸਬਜ਼ੀਆਂ ਦੀ ਵਰਤੋਂ ਨਾ ਕਰੀਏ ਅਤੇ ਸ ਸਬਜ਼ੀ ਤੋਂ ਇਲਾਵਾ ਜਿਹੜੇ ਸਬਜ਼ੀ ਕੱਟਣ ਦੇ ਲੀਏ ਸਾਨੂੰ ਔਜ਼ਾਰ ਚਾਹੀਦੇ ਨੇ ਜਿਵੇਂ ਕਿ ਸਾਡੀ ਕਰਦ ਹੋਣੀ ਚਾਹੀਦੀ ਹੈ ਜਾਂ ਸਾਨੂੰ ਕਿਤੇ ਸੀਜ਼ਰ ਦੀ ਜ਼ਰੂਰਤ ਪੈਂਦੀ ਹੈ ਜਿਹੜੀ ਸਾਡੀ ਰਸੋਈ ਘਰ ਦੇ ਵਿੱਚ ਉਸ ਦੀ ਕੈਂਚੀ ਹੁੰਦੀ ਹੈ ਉਹ ਵੀ ਹਮੇਸ਼ਾ ਸਾਫ਼ ਹੋਣੀ ਚਾਹੀਦੀ ਹੈ ਅਤੇ ਉਸ ਤੋਂ ਇਲਾਵਾ ਜ਼ਿਹੜਾ ਸਾਡਾ ਚੌਪਿੰਗ ਬੌਰਡ ਹੈ ਜਿਹਦੇ 'ਤੇ ਉੱਪਰ ਆਪਾਂ ਸਬਜ਼ੀਆਂ ਕੱਟਣੀਆਂ ਨੇ ਉਹ ਵੀ ਸਾਫ਼ ਹੋਣੀ ਚਾਹੀਦੀ ਹੈ ਸਬਜ਼ੀਆਂ ਅਤੇ ਔਜ਼ਾਰ ਤੋਂ ਇਲਾਵਾ ਸਾਨੂੰ ਜਿਹੜੀ ਸਾਡੇ ਆਪਣੇ ਹੱਥ ਹੈ ਉਹ ਵੀ ਵਾਰ ਵਾਰ ਧੋਣੇ ਚਾਹੀਦੇ ਨੇ ਹੱਥ ਵਗੈਰਾ ਧੋਣ ਤੋਂ ਬਾਅਦ ਜਦੋਂ ਵੀ ਆਪਾਂ ਸਬਜ਼ੀਆਂ ਕੱਟਣੀਆਂ ਨੇ ਉਹ ਸਬਜ਼ੀਆਂ ਸਾਨੂੰ ਪਹਿਲਾਂ ਬੋਆਇਲ ਕਰਨੀਆਂ ਚਾਹੀਦੀਆਂ ਨੇ ਅਗਰ ਬੋਆਇਲ ਵਾਲੀਆਂ ਸਬਜ਼ੀਆਂ ਨਹੀਂ ਹੈ ਤਾਂ ਸਾਨੂੰ ਉਸ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਪਾਣੀ ਦੇ ਵਿੱਚ ਘੱਟੋ ਘੱਟ ਪੰਜ ਤੋਂ ਸੱਤ ਮਿੰਟ ਉਸ ਨੂੰ ਪਾਣੀ ਦੇ ਥੱਲੇ ਹੈ ਧੋਣਾ ਚਾਹੀਦਾ ਹੈ ਤਾਂ ਕਿ ਜਿਹੜੀਆਂ ਸਾਡੀਆਂ ਸਬਜ਼ੀਆਂ ਨੇ ਉਹਦੇ ਵਿੱਚ ਕੋਈ ਵੀ ਗੰਦਗੀ ਕਿਸੇ ਤਰ੍ਹਾਂ ਦਾ ਕੋਈ ਸੁੰਡੀ ਜਾਂ ਕੁਛ ਵੀ ਇਹੋ ਜਿਹੀਆਂ ਚੀਜ਼ਾਂ ਨੇ ਉਹ ਸਾਫ਼ ਹੋ ਜਾਣ ਉਹ ਨਿੱਕਲ ਜਾਣ ਉਸ ਤੋਂ ਬਾਅਦ ਜਦੋਂ ਅਸੀਂ ਸਬਜ਼ੀ ਵਗੈਰਾ ਬਣਾਉਣੀ ਹੈ ਤਾਂ ਉਸ ਨੂੰ ਇੱਕ ਸਾਫ਼ ਭਾਂਡੇ ਦੇ ਵਿੱਚ ਪਹਿਲਾਂ ਹੀ ਕੱਟ ਕੇ ਰੱਖਣਾ ਹੈ ਅਤੇ ਜਿਹੜੀ ਸਾਡੀ ਸਬਜ਼ੀ ਬਣਾਉਣ ਤੋਂ ਪਹਿਲਾਂ ਇਹ ਸਾਨੂੰ ਕੜਾਹੀ ਵਗੈਰਾ ਉਹ ਵੀ ਸਾਫ਼ ਚਾਹੀਦੀ ਹੈ ਜਿਵੇਂ ਕਿ ਅਗਰ ਮੈਂ ਆਪਣਾ ਦੱਸਾਂ ਤਾਂ ਮੈਂ ਜਦੋਂ ਵੀ ਜਿੱਦਾਂ ਇੱਕ ਸਬਜ਼ੀ ਆਪਾਂ ਮਿਕਸ ਵੈਜ ਲੈ ਲਈਏ ਤਾਂ ਉਸ ਤੋਂ ਪਹਿਲਾਂ ਵੀ ਮੈਂ ਬਹੁਤ ਸਾਰੀਆਂ ਜਿਹੜੀਆਂ ਤਿਆਰੀਆਂ ਹੈ ਪਹਿਲਾਂ ਹੀ ਕਰਕੇ ਰੱਖਦੀ ਹਾਂ ਜਿਵੇਂ ਕਿ ਮੈਨੂੰ ਮਿਕਸ ਵੈਜ ਬਜਾ ਅ ਬਣਾਉਣ ਦੇ ਲੀਏ ਅਗਰ ਸ ਬਹੁਤ ਸਾਰੀਆਂ ਚ ਸਬਜ਼ੀਆਂ ਦੀ ਲੋੜ ਪੈਂਦੀ ਹੈ ਜਿੱਦਾਂ ਕਿ ਸਭ ਤੋਂ ਪਹਿਲਾਂ ਗਾਜਰ ਗਾਜਰਾਂ ਨੂੰ ਮੈਂ ਪਹਿਲਾਂ ਹੀ ਧੋ ਕੇ ਚੰਗੀ ਤਰ੍ਹਾਂ ਪਾਣੀ ਦੇ ਥੱਲੇ ਪੰਜ ਤੋਂ ਸੱਤ ਮਿੰਟ ਉਹਨਾਂ ਨੂੰ ਪਾਣੀ ਦੇ ਥੱਲੇ ਰੱਖ ਕੇ ਧੋ ਕੇ ਉਸ ਨੂੰ ਛਿੱਲ ਕੇ ਚੌਪਿੰਗ ਬੌਰਡ 'ਤੇ ਸਾਫ਼ ਕਰਦ ਦੇ ਨਾਲ ਕੱਟ ਕੇ ਉਹਨਾਂ ਨੂੰ ਇੱਕ ਸਾਫ਼ ਭਾਂਡੇ ਦੇ ਵਿੱਚ ਰੱਖ ਲੈਂਦੀ ਹਾਂ ਉਵੇਂ ਹੀ ਜਦੋਂ ਮੈਨੂੰ ਹੋਰ ਸ਼ਿਮਲਾ ਮਿਰਚ ਚਾਹੀਦੀ ਹੈ ਤਾਂ ਸ਼ਿਮਲਾ ਮਿਰਚ ਨੂੰ ਵੀ ਮੈਂ ਧੋ ਕੇ ਉਸ ਨੂੰ ਵੀ ਕਰਦ ਦੇ ਨਾਲ ਕੱਟ ਕੇ ਸਾਫ਼ ਭਾਂਡੇ ਦੇ ਵਿੱਚ ਅਲੱਗ ਤੋਂ ਰੱਖ ਲੈਂਦੀ ਹਾਂ ਐਵੇਂ ਹੀ ਹੋਰ ਸਬਜ਼ੀਆਂ ਜਿੱਦਾਂ ਬਰੋਕਲੀ ਹੋ ਗਈ ਗੋਭੀ ਹੋ ਗਈ ਇਹਨਾਂ ਨੂੰ ਵੀ ਜਿਮੀਕੰਦ ਹੋ ਗਿਆ ਬੀਨਜ਼ ਚਾਹੀਦੇ ਨੇ ਤਾਂ ਇਹਨਾਂ ਨੂੰ ਵੀ ਅਲੱਗ ਤੋਂ ਧੋ ਕੇ ਕੱਟ ਕੇ ਹ ਇਹਨਾਂ ਨੂੰ ਸਬਜ਼ੀਆਂ ਨੂੰ ਜਦੋਂ ਆਪਾਂ ਕੱਟਦੇ ਹਾਂ ਸਾਨੂੰ ਇਕੱਠੇ ਵੀ ਨਹੀਂ ਕੱਟਣਾ ਚਾਹੀਦਾ ਸਾਨੂੰ ਇਹਨਾਂ ਨੂੰ ਅਲੱਗ ਅਲੱਗ ਹੀ ਕੱਟਣਾ ਚਾਹੀਦਾ ਹੈ ਤਾਂ ਕਿ ਜਿਹੜੀ ਇੱਕ ਸਬਜ਼ੀ ਹੈ ਅਗਰ ਉਹ ਗੰਦੀ ਹੈ ਤਾਂ ਸਾਨੂੰ ਦੂਸਰੀ ਦੇ ਵਿੱਚ ਨਾ ਜਾਵੇ ਵੈਸੇ ਤਾਂ ਸਾਨੂੰ ਹਰ ਸਬਜ਼ੀ ਧੋਣੀ ਹੀ ਪੈ ਧੋਣੀ ਹੀ ਹੈ ਆਪਾਂ ਕੱਟਣ ਤੋਂ ਪਹਿਲਾਂ ਵੀ ਕੱਟਣ ਤੋਂ ਬਾਅਦ ਵੀ ਪਰ ਫਿਰ ਵੀ ਸਾਨੂੰ ਉਦੋਂ ਤੱਕ ਸਬਜ਼ੀ ਮਿਕਸ ਨਹੀਂ ਕਰਨੀ ਚਾਹੀਦੀ ਜਦੋਂ ਤੱਕ ਆਪਾਂ ਉਸ ਨੂੰ ਕੜਾਹੀ ਦੇ ਵਿੱਚ ਨਹੀਂ ਪਾ ਦਿੰਦੇ ਐਵੇਂ ਹੀ ਅਗਰ ਸਾਨੂੰ ਆਲੂ ਚਾਹੀਦੇ ਨੇ ਆਲੂ ਦੇ ਵਿੱਚ ਕਈ ਵਾਰ ਬਹੁਤ ਜ਼ਿਆਦਾ ਗੰਦਗੀ ਉਹ ਮੰਡੀ ਤੋਂ ਹੀ ਬਹੁਤ ਜ਼ਿਆਦਾ ਗੰਦਗੀ ਵਾਲੇ ਆਉਂਦੇ ਨੇ ਤਾਂ ਆਪਾਂ ਗਰਮ ਪਾਣੀ ਦੇ ਵਿੱਚ ਗਰਮ ਪਾਣੀ ਦੇ ਨਾਲ ਆਲੂ ਨੂੰ ਮੂਲੀ ਨੂੰ ਗਾਜਰਾਂ ਨੂੰ ਇਹੋ ਜਿਹੀਆਂ ਜਿਹੜੀਆਂ ਸਬਜ਼ੀਆਂ ਹੁੰਦੀਆਂ ਨੇ ਸਾਨੂੰ ਇਹਨਾਂ ਨੂੰ ਗਰਮ ਪਾਣੀ ਦੇ ਨਾਲ ਧੋਣਾ ਚਾਹੀਦਾ ਤਾਂ ਕਿ ਜਿਹੜੀ ਗੰਦਗੀ ਹੈ ਉਹ ਚੰਗੀ ਤਰ੍ਹਾਂ ਨਿਕਲ ਜਾਵੇ ਉਸ ਤੋਂ ਬਾਅਦ ਸਾਡੇ ਕੋਲ ਇਹੋ ਜਿਹੇ ਡੇਅਰੀ ਪ੍ਰੋਡਕਟ ਜਿਹੜੇ ਹੁੰਦੇ ਨੇ ਪਦਾਰਥ ਹੁੰਦੇ ਨੇ ਜਿੱਦਾਂ ਕਿ ਸਾਡੇ ਕੋਲ ਪਨੀਰ ਆ ਗਿਆ ਸਾਨੂੰ ਇਸ ਨੂੰ ਵੀ ਪਾਣੀ ਦੇ ਵਿੱਚ ਠੰਡੇ ਪਾਣੀ ਦੇ ਵਿੱਚ ਬਰਫ਼ ਵਾਲੇ ਪਾਣੀ ਦੇ ਵਿੱਚ ਥੋੜ੍ਹੀ ਦੇਰ ਭਿੱਗੋ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਉਹ ਵੀ ਜਿਹੜੀ ਪਨੀਰ ਹੈ ਅਗਰ ਕਿਸੇ ਦਾ ਗੰਦਾ ਹੱਥ ਵਗੈਰਾ ਲੱਗਾ ਹੈ ਤਾਂ ਉਹ ਵੀ ਸਾਫ਼ ਹੋ ਜਾਵੇ ਉਸ ਤੋਂ ਬਾਅਦ ਹੀ ਜਿਹੜੀਆਂ ਅਸੀਂ ਸਬਜ਼ੀਆਂ ਹੈ ਆਪਣੀਆਂ ਬਣਾਉਣੀ ਸ਼ੁਰੂ ਕਰਨੀਆਂ ਖਾਣਾ ਬਣਾਉਣ ਤੋਂ ਪਹਿਲਾਂ ਸਬਜ਼ੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਬਜ਼ੀਆਂ ਚੰਗੀ ਤਰ੍ਹਾਂ ਉਹ ਹੋਣੀਆ ਚਾਹੀਦੀਆਂ ਨੇ ਸਬਜ਼ੀਆਂ ਕੱਟਣ ਤੋਂ ਪਹਿਲਾਂ ਅਤੇ ਕੱਟਣ ਤੋਂ ਬਾਅਦ ਧੋਣੀਆਂ ਚਾਹੀਦੀਆਂ ਨੇ ਇਸ ਤੋਂ ਇਲਾਵਾ ਜਿਹੜੇ ਸਾਡੇ ਬਰਤਨ ਨੇ ਜਿਸ ਦੇ ਵਿੱਚ ਅਸੀਂ ਖਾਣਾ ਬਣਾਉਣਾ ਹੈ ਉਹ ਵੀ ਚੰਗੀ ਤਰ੍ਹਾਂ ਸਾਫ਼ ਹੋਣੇ ਚਾਹੀਦੇ ਨੇ